ਮੈਂ ਜਦੋਂ ਵੀ ਯੋਗ ਅਭਿਆਸ ਕਰਦਾ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਫਾਲਤੂ ਦੇ ਵਿਚਾਰ ਨਹੀਂ ਰੱਖਦਾ ਦਿਮਾਗ ਨੂੰ ਜਮ੍ਹਾਂ ਖਾਲੀ ਕਰਕੇ ਯੋਗ ਕਰਦਾ ਹਾਂ ਤਾਂ ਕਿ ਮੈਨੂੰ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ ਅਤੇ ਮੇਰੇ ਜੀਵਨ ਦੇ ਵਿੱਚ ਸੁਧਾਰ ਹੋ ਸਕੇ ਜੇਕਰ ਮੈਂ ਦਿਮਾਗ ਦੇ ਵਿੱਚ ਕੋਈ ਫਾਲਤੂ ਵਿਚਾਰ ਜਾਂ ਇਧਰ ਉਧਰ ਦੀਆਂ ਗੱਲਾਂ ਰੱਖ ਕੇ ਯੋਗ ਅਭਿਆਸ ਕਰਾਂਗਾ ਤਾਂ ਮੇਰਾ ਉਹ ਕੋਈ ਜ਼ਿਆਦਾ ਫ਼ਾਇਦੇਮੰਦ ਵਾਲੀ ਗੱਲ ਨਹੀਂ ਰਹੇਗੀ